ਜਦੋਂ ਵੀ ਕੋਈ ਲਿਖਣ ਲੱਗਦਾ ਹੈ ਤਾਂ ਪਹਿਲਾਂ ਉਹਨੇ ਕੁਛ ਨਾ ਕੁਛ ਕਿਸੇ ਦੀ ਲਿਖਤ ਨੂੰ ਪੜ੍ਹਿਆ ਹੁੰਦਾ ਮੈਂ ਵੀ ਬਹੁਤ ਸਾਰੇ ਲਿਖਾਰੀਆਂ ਦੀਆਂ ਰਚਨਾਵਾਂ ਪੜ੍ਹੀਆਂ ਔਰ ਜਿਹਨਾਂ ਦੇ ਕਰਕੇ ਮੈਨੂੰ ਲਿਖਣ ਦਾ ਇੱਕ ਚਾਅ ਜਿਹਾ ਉੱਠਿਆ ਉਹਨਾਂ ਵਿੱਚ ਜਿਵੇਂ ਕਿ ਸੁਰਜੀਤ ਪਾਤਰ ਔਰ ਭਾਈ ਵੀਰ ਸਿੰਘ ਔਰ ਬਲਵੰਤ ਸਿੰਘ ਗਾਰਗੀ ਇਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਿਆ ਜਿਸ ਨਾਲ ਮੈਨੂੰ ਬਹੁਤ ਚੰਗਾ ਲੱਗਿਆ ਅਤੇ ਮੇਰੇ ਮਨ ਦੇ ਵਿੱਚ ਵੀ ਲਿਖਣ ਦਾ ਚਾਅ ਪੈਦਾ ਹੋਇਆ ਅਤੇ ਇਹਨਾਂ ਦੀਆਂ ਲਿਖਤਾਂ ਮੈਂ ਪੜ੍ਹੀਆਂ ਤਾਂ ਮੈਨੂੰ ਬਹੁਤ ਵਧੀਆ ਲੱਗੀਆਂ ਕਿਉਂਕਿ ਉਹਨਾਂ ਵਿੱਚ ਉਹਨਾਂ ਨੇ ਬੜੇ ਸਰਲ ਤਰੀਕੇ ਦੇ ਨਾਲ ਆਪਣੇ ਮਨ ਦੀਆਂ ਗੱਲਾਂ ਸਾਨੂੰ ਸਮਝਾਈਆਂ ਅਤੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜੀਣ ਦੇ ਤਰੀਕੇ ਦੱਸੇ ਇਸੇ ਕਰਕੇ ਉਹਨਾਂ ਦੀਆਂ ਰਚਨਾਵਾਂ ਤੋਂ ਹੀ ਉਤਸਾਹਿਤ ਹੋ ਕੇ ਮੈਂ ਵੀ ਲਿਖਣ ਲੱਗਿਆ ਅਤੇ ਮੇਰੇ 'ਤੇ ਇਹਨਾਂ ਦਾ ਕੁਛ ਪ੍ਰਭਾਵ ਵੀ ਹੈ ਇਸ ਤੋਂ ਇਲਾਵਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਚਨਾਵਾਂ ਹਨ ਜਾਂ ਜੋ ਵੀ ਗੁਰਬਾਣੀ ਦਰਜ ਹੈ ਉਹਨਾਂ ਦਾ ਵੀ ਮੇਰੀ ਜ਼ਿੰਦਗੀ ਦੇ ਉੱਤੇ ਬਹੁਤ ਅਸਰ ਪਿਆ ਅਤੇ ਮੇਰੀਆਂ ਰਚਨਾਵਾਂ ਦੇ ਵਿੱਚ ਮੇਰੀ ਲਿਖਤ ਦੇ ਵਿੱਚ ਉਹਨਾਂ ਦਾ ਵੀ ਜ਼ਿਕਰ ਮੈਂ ਬਹੁਤ ਜ਼ਿਆਦਾ ਕਰਦਾ ਹਾਂ ਕਿਉਂਕਿ ਉਹ ਸਾਡੇ ਜੀਵਨ ਦੇ ਤੱਤ ਨੇ ਗੁਰਬਾਣੀ ਦੇ ਵਿੱਚ ਜੋ ਲਿਖਿਆ ਗਿਆ ਹੈ ਉਹ ਸਾਡੇ ਜੀਵਨ ਦੀਆਂ ਸੱਚਾਈਆਂ ਨੇ ਅਤੇ ਉਹਨਾਂ ਨੂੰ ਸਮਝ ਕੇ ਹੀ ਮੈਂ ਇਹ ਮਹਿਸੂਸ ਕੀਤਾ ਕਿ ਆਪਣੀ ਲਿਖਤ ਦੇ ਵਿੱਚ ਇਤਨਾ ਸਰਲ ਲਿਖੋ ਕਿ ਪੜ੍ਹਨ ਵਾਲੇ ਨੂੰ ਵੀ ਚੰਗਾ ਲੱਗੇ ਅਤੇ ਉਹ ਜ਼ਿਆਦਾ ਤੋਂ ਜ਼ਿਆਦਾ ਤੁਹਾਡੀ ਲਿਖਤ ਨੂੰ ਪੜ੍ਹੇ